ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਪੰਜਾਬ ਬੋਹ ਪੰਜਾਬ ਕਲਚਰ ਕਾਫ਼ੀ ਪੁਰਾਣਾ ਚੱਲਦਾ ਆ ਰਿਹਾ ਇੱਥੇ ਬਹੁਤ ਕੁਛ ਖਾਣ ਨੂੰ ਬਹੁਤ ਵਧੀਆ ਹੈ ਅਤੇ ਜਿਵੇਂ ਅੰਮ੍ਰਿਤਸਰ ਦੇ ਕੁਲਚੇ ਬਹੁਤ ਜ਼ਿਆਦਾ ਫੇਮਸ ਆ ਤੁਸੀਂ ਸੁਣਿਆ ਹੀ ਹੋਣਾ ਅਤੇ ਅੰਮ੍ਰਿਤਸਰ ਦੇ ਕੁਲਚੇ ਬਹੁਤ ਫੇਮਸ ਹੈ ਜਿਵੇਂ ਸਿੱਖਾਂ ਵਾਸਤੇ ਗੁਰਦੁਆਰੇ ਦੇ ਜਿਹੜੇ ਲੰਗਰ ਹੋ ਗਿਆ ਫੁਲਕੇ ਨਾਲ ਦਾਲ ਅਤੇ ਪ੍ਰਸ਼ਾਦ ਬਹੁਤ ਜ਼ਿਆਦਾ ਫੇਮਸ ਹੈ

ਹਾਂਜੀ ਹਾਂਜੀ ਹਾਂਜੀ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਜੋ ਬਹੁਤ ਜ਼ਿਆਦਾ ਫੇਮਸ ਸਭ ਤੋਂ ਜ਼ਿਆਦਾ ਫੇਮਸ ਹੀ ਇਹ ਹੈ ਅਤੇ ਪੰਜਾਬ ਦੇ ਕਲਚਰ ਵਿੱਚ ਇਹ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਅਤੇ ਹੋਰ ਵੀ ਕਾਫ਼ੀ ਕਾਫ਼ੀ ਕੁਛ ਹੈ ਜਿਵੇਂ ਬੇਸਨ ਸੂ ਬੇਸਨ ਦਾ ਸੂਜੀ ਦਾ ਹਲਵਾ ਹੋ ਗਿਆ ਅਤੇ ਮਿੱਠੇ ਗੁਲਗਲੇ ਅਤੇ ਪੂੜੇ ਲੋਕ ਮੀਂਹ ਵਾਲੇ ਮੌਸਮ ਦੇ ਵਿੱਚ ਖਾਣਾ ਬਹੁਤ ਪਸੰਦ ਕਰਦੇ ਹੈ ਅਤੇ ਹੋਰ ਵੀ ਕਾਫ਼ੀ ਕੁਛ ਹੋ ਗਿਆ ਜਿਵੇਂ ਨਾਨ ਵਗੈਰਾ ਹੋ ਗਏ ਰੁ ਅ ਰੁਮਾਲੀ ਰੋਟੀ

ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਸਾਰੀ ਚੀਜ਼ਾਂ ਤੁਸੀਂ ਬਹੁਤ ਜ਼ਿਆਦਾ ਵ ਵਧੀਆ ਬਲੋਗ ਬਣਾ ਸਕਦੇ ਹੋ ਅਤੇ ਹਾਂ ਹਾਂਜੀ ਹਾਂਜੀ ਐਜ ਹੈਲਥੀ ਇਨਗ੍ਰੀਡੀਐਂਟ ਤੁਸੀਂ ਪੰਜੀਰੀ ਨੂੰ ਮਿੱਠੇ ਵਿੱਚ ਖਾ ਸਕਦੇ ਹੋ ਹਾਂਜੀ ਪੰਜੀਰੀ ਐਕਚੁਲੀ ਘਰ ਦੇ ਵਿੱਚ ਬਣਾਈ ਜਾਂਦੀ ਹੈ ਅਤੇ ਘਰ ਦਾ ਘੀ ਅਤੇ ਮੱਖਣ ਵਗੈਰਾ ਉਹ ਵੀ ਲੋਕ ਘਰ ਵਿੱਚ ਵਿੱਚ ਬਣਾਉਂਦੇ ਹੈ ਹੋਰ ਚਾਟੀ ਦੀ ਲੱਸੀ ਚਾਟੀ ਦੀ ਲੱਸੀ ਜੋ ਉਹ ਖਾਂਦੇ ਹੈ ਸਰਸੋਂ ਦੇ ਸਾਗ ਦੇ ਨਾਲ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਵਿੱਚ ਕੁਲਚਾ ਬਹੁਤ ਫੇਮਸ ਹੈ ਅਤੇ ਨਾਨ ਵਗੈਰਾ ਹੋ ਗਿਆ ਅਤੇ ਉੱਥੇ ਨੋਨ ਵੈਜੀਟੇਰੀਅਨ ਵਾਲੀ ਚੀਜ਼ਾਂ ਵੀ ਕਾਫ਼ੀ ਫੇਮਸ ਹੈ ਜੋ ਜਾਣੀਆਂ ਜਾਂਦੀਆਂ ਕੁਛ ਸ਼ੋਪਸ ਦੇ ਵਿੱਚ ਹਾਂਜੀ ਹਾਂਜੀ ਮੈਨੂੰ ਕਾਲ ਕਰ ਦਿਓ ਹਾਂਜੀ ਹਾਂਜੀ ਨਾਈਸ ਟੂ ਕਾਲ ਯੂ ਥੈਂਕ ਯੂ